ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਧਰਵੀ ਗੱਲ ਕਰ ਰਿਹਾਂ ਤੁਸੀਂ ਇਸ ਟਾਈਮ ਫ੍ਰੀ ਹੋ ਤੁਸੀਂ ਹਾਂਜੀ ਜਿਵੇਂ ਨਾ ਮੈਂ ਕਿ ਮੈਨੂੰ ਬੈਂਗਲੌਰ ਸਾਈਡ ਤੋਂ ਮੈਨੂੰ ਦਸ ਤੋਂ ਪੰਦਰਾਂ ਸਾਲ ਹੋ ਗਏ ਹੈ ਅਤੇ ਬਹੁਤ ਟਾਈਮ ਬਾਅਦ ਮੇਰਾ ਇੱਧਰ ਮੋਹਾਲੀ ਆਉਣ ਦਾ ਮਤਲਬ ਪਲੈਨ ਬਣ ਰਿਹਾ ਹੈ ਅਤੇ ਮਤਲਬ ਔਫਿਸ ਟਾਈਮ ਤੋਂ ਵੀ ਮੈਂ ਮੈਂ ਥੋੜ੍ਹਾ ਫ੍ਰੀ ਹਾਂ ਪੰਦਰਾਂ ਵੀਹ ਦਿਨ ਲਈ ਮੈਨੂੰ ਔਫ ਮਿਲਿਆ ਹੈ ਮੈਨੂੰ ਅਤੇ ਮੈਂ ਚਾਹੁੰਦਾ ਕਿ ਇੱਧਰ ਮੈਂ ਮੋਹਾਲੀ ਘੁੰਮਣ ਆਵਾਂ ਅਤੇ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੋਹਾਲੀ ਘੁੰਮਣ ਲਈ ਸਭ ਤੋਂ ਵਧੀਆ ਥਾਵਾਂ ਕਿਹੜੀਆਂ ਹੈ ਓਕੇ ਓਕੇ ਠੀਕ ਹੈ ਜੀ ਠੀਕ ਹੈ ਜੀ ਚਲੋ ਕੋਈ ਨਹੀਂ ਜੀ ਮੇਰੀ ਟਿਕਟ ਜਿਵੇਂ ਹੀ ਫਾਈਨਲ ਹੁੰਦੀ ਹੈ ਮੈਂ ਤੁਹਾਨੂੰ ਉਹ ਕਰ ਕੇ ਨਾ ਆਪਣਾ ਤੁਹਾਨੂੰ ਦੱਸਦਾ ਅਤੇ ਜਦੋਂ ਮੇਰੀ ਟਿਕਟ ਫਾਈਨਲ ਹੋ ਗਈ ਜੀ ਮੈਂ ਤੁਹਾਡੇ ਨਾਲ ਆਪਣਾ ਮਤਲਬ ਕੌਂਟੈਕਟ ਕਰਦਾ ਅਤੇ ਤੁਸੀਂ ਮੈਨੂੰ ਜਿਵੇਂ ਵੀ ਉਹਨਾਂ ਦੇ ਗੂਗਲ ਲਿੰਕ ਹੋਏ ਜਾਂ ਤੁਸੀਂ ਵਿਹਲੇ ਹੋਏ ਤੁਸੀਂ ਮੇਰੀ ਕਿੰਨੀ ਕੁ ਮਤਲਬ ਤੁਹਾਡੇ ਤੋਂ ਹੁੰਦਾ ਹੋਇਆ ਤੁਸੀਂ ਹੈਲਪ ਕਰ ਦਿਉ ਮੇਰੀ

ਠੀਕ ਠੀਕ ਹੈ ਜੀ ਠੀਕ ਓਕੇ ਧੰਨਵਾਦ ਜੀ ਬਹੁਤ ਬਹੁਤ